ਮੈਂ ਆਪਣੇ ਸਕੂਲ ਦੇ ਟਾਈਮ ਵਿੱਚ ਬਹੁਤ ਪੇਂਟਿੰਗ ਦੀਆਂ ਕਲਾਵਾਂ ਸਿੱਖੀਆਂ ਸਾਨੂੰ ਸਾਡੇ ਅਧਿਆਪਕ ਨੇ ਬਹੁਤ ਉਤਸ਼ਾਹਿਤ ਕੀਤਾ ਸਾਡੇ ਸਕੂਲ ਵਿੱਚ ਛੋਟੇ ਛੋਟੇ ਪੇਂਟਿੰਗ ਦੇ ਕੋਂਪੀਟੀਸ਼ਨਸ ਹੋਇਆ ਕਰਦੇ ਸਨ ਜਿਨ੍ਹਾਂ ਵਿੱਚ ਸਾਡੇ ਟੀਚਰ ਸਾਨੂੰ ਪਾਰਟੀਸਪੇਸਟ ਕਰਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ ਜਦੋਂ ਅਸੀਂ ਉਹਨਾਂ ਵਿੱਚ ਪਾਰਟੀਸਪੇਟ ਕਰਦੇ ਸਾਂ ਤਾਂ ਉਹਨਾਂ ਦੀ ਤਿਆਰੀ ਲਈ ਸਾਡੇ ਟੀਚਰ ਸਾਨੂੰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੱਸਦੇ ਸਨ ਜਿਸ ਨਾਲ ਅਸੀਂ ਆਪਣੇ ਪੇਂਟਿੰਗ ਵਿੱਚ ਸੁਧਾਰ ਲਿਆ ਸਕਦੇ ਸਾਂ ਸਾਡੇ ਟੀਚਰ ਸਾਨੂੰ ਬਹੁਤ ਵਧੀਆ ਢੰਗ ਨਾਲ ਪੇਂਟਿੰਗ ਸਿਖਾਉਣ ਲਈ ਪ੍ਰੇਰਿਤ ਕਰਦੇ ਸਨ ਸਕੂਲ ਵਿੱਚ ਸਿੱਖੀ ਪੇਂਟਿੰਗ ਮੈਨੂੰ ਹਾਲੇ ਤੱਕ ਯਾਦ ਹੈ ਕਿਉਂਕਿ ਇਸ ਨਾਲ ਮੇਰੀ ਪੇਂਟਿੰਗ ਦੀ ਕਲਾ ਵਿੱਚ ਬਹੁਤ ਸੁਧਾਰ ਆਇਆ ਮੇਰੇ ਟੀਚਰ ਨੇ ਮੈਨੂੰ ਪਹਿਲਾਂ ਛੋਟੀਆਂ ਛੋਟੀਆਂ ਪੇਂਟਿੰਗਸ ਬਣਾਉਣ ਲਈ ਕਿਹਾ ਅਤੇ ਜਦੋਂ ਮੈਂ ਇਹ ਪੇਂਟਿੰਗਸ ਬਣਾਉਂਦੀ ਰਹੀ ਤਾਂ ਉਹਨਾਂ ਨੇ ਇਹਦੇ ਵਿੱਚ ਕੁਝ ਕਮੀਆਂ ਕੱਢਣੀਆਂ ਅਤੇ ਇਹਨੂੰ ਸੁਧਾਰਨ ਲਈ ਮੈਨੂੰ ਕੁਝ ਢੰਗ ਤਰੀਕੇ ਵੀ ਸਿਖਾਉਣੇ ਇਸ ਨਾਲ ਮੈਂ ਹੌਲੀ ਹੌਲੀ ਆਪਣੀ ਪੇਂਟਿੰਗ ਦੀ ਕਲਾ ਵਿੱਚ ਬਹੁਤ ਸੁਧਾਰ ਲਿਆਂਦਾ ਅਤੇ ਅੱਜ ਮੈਂ ਬਹੁਤ ਵਧੀਆ ਪੇਂਟਿੰਗ ਕਰ ਲੈਂਦੀ ਹਾਂ ਪਰੰਤੂ ਹਾਲੇ ਵੀ ਨਿੱਕੀਆਂ ਨਿੱਕੀਆਂ ਉਕਾਈਆਂ ਰਹਿ ਹੀ ਜਾਂਦੀਆਂ ਹਨ ਸਾਡੇ ਅਧਿਆਪਕ ਸਾਨੂੰ ਬਹੁਤ ਵਧੀਆ ਢੰਗ ਨਾਲ ਸਮਝਾ ਕੇ ਅਤੇ ਸਾਡੀ ਆਪ ਸਹਾਇਤਾ ਕਰਕੇ ਸਾਨੂੰ ਸਾਡੇ ਹੁਨਰ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੇ ਰਹੇ ਸਨ ਜਿਸ ਨਾਲ ਸਾਨੂੰ ਅੱਜ ਵੀ ਉਹਨਾਂ ਨੂੰ ਧੰਨਵਾਦ ਕਰਨ ਦੀ ਲੋੜ ਪੈਂਦੀ ਹੈ ਕਿ ਉਹਨਾਂ ਨੇ ਸਾਨੂੰ ਇੰਨੇ ਚੰਗੇ ਹੁਨਰ ਸਿਖਾਏ ਸਕੂਲ ਵਿੱਚ ਪੇਂਟਿੰਗ ਸਿੱਖਣ ਤੋਂ ਬਾਅਦ ਮੈਂ ਬਲੋਕ ਲੈਵਲ 'ਤੇ ਪੇਂਟਿੰਗ ਮੁਕਾਬਲੇ ਵਿੱਚ ਵੀ ਪਾਰਟੀਸਪੇਟ ਕੀਤਾ ਅਤੇ ਉੱਥੇ ਮੈਨੂੰ ਸੈਕਿੰਡ ਪ੍ਰਾਈਜ਼ ਮਿਲਿਆ ਜਿਸ ਨਾਲ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਅਤੇ ਮੇਰੇ ਅਧਿਆਪਕ ਨੇ ਵੀ ਬਹੁਤ ਮਹਿਣ ਮਾਣ ਮਹਿਸੂਸ ਕੀਤਾ ਇਸ ਨਾਲ ਮੈਨੂੰ ਹੋਰ ਉਤਸ਼ਾਹ ਮਿਲਿਆ ਅਤੇ ਮੈਂ ਅੱਗੇ ਤੋਂ ਹੋਰ ਕੋਪੀਟੀਸ਼ਨ ਵਿੱਚ ਪਾਰਟੀਸਪੇਟ ਕਰਨ ਲਈ ਮੋਟੀਵੇਟ ਵੀ ਹੋਈ ਅਤੇ ਨਾਲ ਹੀ ਮੈਂ ਆਪਣੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਵੀ ਕੀਤਾ ਇਸ ਦੇ ਨਾਲ ਹੀ ਮੇਰੇ ਫਰੈਂਡਸ ਵੀ ਮੇਰੇ ਨਾਲ ਪੇਂਟਿੰਗ ਕਰਦੇ ਹਨ ਅਤੇ ਅਸੀਂ ਮਿਲ ਕੇ ਬਹੁਤ ਸੁੰਦਰ ਸੁੰਦਰ ਪੇਂਟਿੰਗਸ ਤਿਆਰ ਕਰਦੇ ਹਾਂ ਜੋ ਕਿ ਅਸੀਂ ਆਪਣੇ ਸਕੂਲ ਅਤੇ ਘਰ ਵਿੱਚ ਵੀ ਲਗਾਈਆਂ ਹੋਈਆਂ ਸਨ ਅਤੇ ਮੇਰੇ ਟੀਚਰਸ ਨੇ ਸਾਡੀਆਂ ਉਹ ਪੇਂਟਿੰਗਸ ਹਾਲੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਧੰਨਵਾਦ